ਹੈਲੋ ਹਾਂਜੀ ਮੈਮ ਨਮਸਤੇ ਮੈਂ ਮੈਡਮ ਮਰੀਗਨੀ ਦੀ ਮੰਮੀ ਮੈਡਮ ਬੋਲ ਰਹੀ ਹਾਂ ਜੋ ਉਹਨੂੰ ਸਕੂਲ ਵਿੱਚ ਪੜ੍ਹਾਉਂਦੀ ਹਾਂ ਤੁਹਾਡੀ ਗੁੜੀਆ ਮੇਰੇ ਕੋਲ ਪੜ੍ਹਨ ਵਾਸਤੇ ਆਉਂਦੀ ਹੈ ਅਤੇ ਉਸ ਦੀ ਅਚਾਨਕ ਹੀ ਤਬੀਅਤ ਖਰਾਬ ਹੋ ਗਈ ਹੈ ਉਹ ਨਾ ਬੇਹੋਸ਼ ਹੋ ਕੇ ਗਿਰ ਚੁੱਕੀ ਹੈ ਅਤੇ ਉਸ ਨੂੰ ਬਹੁਤ ਜ਼ਿਆਦਾ ਫੀਵਰ ਹੋ ਚੁੱਕਿਆ ਹੈ ਹਾਂ ਮੈਡਮ ਬਿਲਕੁਲ ਠੀਕ ਗਈ ਸੀ ਮੈਂ ਮੰਨ ਲਿਆ ਪਰ ਉਹ ਜਦੋਂ ਸਕੂਲ ਵਿੱਚ ਥੋੜ੍ਹਾ ਖੇਡ ਰਹੀ ਸੀ ਅਤੇ ਉਹ ਉਸ ਦਾ ਮਤਲਬ ਖੇਡਣ ਦੇ ਨਾਲ ਹੋ ਉਸਨੂੰ ਥੋੜ੍ਹਾ ਥੋੜ੍ਹਾ ਬੁਖਾਰ ਸੀ ਤੁਸੀਂ ਸਵੇਰੇ ਚੈੱਕ ਨਹੀਂ ਕੀਤਾ ਪਰ ਉਸ ਨੂੰ ਥੋੜ੍ਹਾ ਬੁਖਾਰ ਸੀ ਹੁਣ ਜਦੋਂ ਉਹ ਸਕੂਲ ਵਿੱਚ ਦੋੜ ਰਹੀ ਸੀ ਅਤੇ ਇਸ ਕਰਕੇ ਉਸਨੂੰ ਜ਼ਿਆਦਾ ਚੱਕਰ ਆ ਰਹੇ ਹਨ ਅਤੇ ਉਹ ਥੋੜ੍ਹਾ ਠੀਕ ਫੀਲ ਨਹੀਂ ਕਰ ਰਹੀ ਹੈ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹਨੂੰ ਘਰ ਵਾਪਸ ਲੈ ਕੇ ਜਾਓ ਅਤੇ ਅੱਛੇ ਡਾਕਟਰ ਨੂੰ ਦਿਖਾਓ ਜਾ ਕੇ ਹਾਂਜੀ ਮੈਡਮ ਮੈਂ ਇਹਦੇ ਪਾਪਾ ਨੂੰ ਹੀ ਇਹਨਾਂ ਨੂੰ ਦੇਵਾਂਗੀ ਠੀਕ ਹੈ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ